ਮੇਰੀ ਚਿੱਤਰਕਾਰੀ ਦਾ ਕੰਮ ਇੱਕ ਅਖਬਾਰ 'ਚ ਜਿਹੜਾ ਚਿੱਤਰਕਾਰੀ ਦਾ ਕੋਰਨਰ ਆਉਂਦਾ ਨਾ ਉਹਦੇ ਵਿੱਚ ਆਇਆ ਸੀਗਾ ਅਤੇ ਵੈਸੇ ਮੈਂ ਸਕੂਲ ਦੇ ਵਿੱਚ ਜਦੋਂ ਬੱਚਿਆਂ ਨੂੰ ਪੇਟਿੰਗ ਕਰਵਾਉਂਦੀ ਹਾਂ ਅਤੇ ਆਪ ਕਰਦੀ ਹਾਂ ਅਤੇ ਉਸ ਦੇ ਵਿੱਚ ਅਸੀਂ ਕੋਂਪੀਟੀਸ਼ਨ ਵੀ ਕਰਵਾਇਆ ਸੀ ਉਸ ਦੇ ਵਿੱਚ ਵੀ ਚਿੱਤਰਕਾਰੀ ਦਾ ਕੰਮ ਮੇਰਾ ਮਤਲਬ ਅਖਬਾਰ ਦੇ ਵਿੱਚ ਫਿਰ ਆਇਆ ਸੀ ਜਿਸ ਅਸੀਂ ਦੱਸਿਆ ਸੀ ਕਿ ਅਸੀਂ ਚਿੱਤਰ ਰਾਹੀਂ ਸਮਝਾਇਆ ਸੀ ਕਿ ਅਸੀਂ ਆਪਣੀ ਪ੍ਰਕਿਰਤੀ ਨੂੰ ਕਿਵੇਂ ਪ੍ਰਦੂਸ਼ਣ ਤੋਂ ਬਚਾਅ ਸਕਦੇ ਹਾਂ ਪ੍ਰਕਿਰਤੀ ਦਾ ਧਿਆਨ ਕਿੱਦਾਂ ਰੱਖਿਆ ਜਾ ਸਕਦਾ ਹੈ ਅਤੇ ਆਪਣੇ ਆਲ਼ੇ ਦੁਆਲ਼ੇ ਨੂੰ ਕਿੱਦਾਂ ਸਾਫ ਸੁਥਰਾ ਬਣਾਇਆ ਜਾ ਸਕਦਾ ਹੈ